ਮੈਨੂੰ ਸੂਜੀ ਦਾ ਕੜਾਹ ਬਣਾਉਣਾ ਬਹੁਤ ਪਸੰਦ ਹੈ ਇਹ ਮੇਰਾ ਮਨਪਸੰਦ ਪਕਵਾਨ ਵੀ ਹੈ ਚਾਹੇ ਇਸ ਨੂੰ ਮੈਂ ਰੋਜ਼ ਬਣਾ ਕੇ ਖਾਈ ਜਾਵਾਂ ਇਸ ਪਕਵਾਨ ਤੋਂ ਮੈਂ ਕਦੇ ਬੋਰ ਨਹੀਂ ਹੁੰਦੀ ਕਿਉਂਕਿ ਮੈਂ ਮਿੱਠੇ ਦੀ ਬਹੁਤ ਸ਼ੌਕੀਨ ਹਾਂ ਤਾਂ ਕਰਕੇ ਮੈਂ ਸੂਜੀ ਦੇ ਕੜਾਹ ਨੂੰ ਅਲੱਗ ਅਲੱਗ ਤਰੀਕਿਆਂ ਨਾਲ ਬਣਾ ਕੇ ਖਾਂਦੀ ਰਹਿੰਦੀ ਹਾਂ ਇਸ ਵਿੱਚ ਮੈਂ ਕਾਜੂ ਦਾਖਾ ਬਦਾਮ ਅਤੇ ਨਾਰੀਅਲ ਦਾ ਬੁਰਾਦਾ ਪਾ ਲੈਂਦੀ ਹਾਂ ਜਿਸ ਕਾਰਨ ਇਹ ਹੋਰ ਵੀ ਸੁਆਦ ਲੱਗਦਾ ਹੈ